ਮੈਂ ਤਾਂ ਬਹੁਤ ਕੰਮ ਕੀਤਾ ਆਪਦੇ ਹੱਥਾਂ ਨਾਲ ਘਰ ਦਾ ਕੰਮ ਕਰਾਂ ਘਰ ਬਣਾ ਕੇ ਸਭ ਕੁਝ ਕੱਪੜੇ ਘਰ ਦੇ ਸੀ ਕੇ ਪਾਈ ਦੇ ਸੀ ਤਾਂ ਇਹ ਬਣਾਈ ਦੇ ਸੀ ਬਾਕੀ ਸਿੱਖਿਆ ਵੀ ਕਈ ਸਿੱਖਿਆ ਕਿਸੇ ਤੋਂ ਨਹੀਂ ਆਪਦੇ ਆਪ ਕੰਮ ਕਰਕੇ ਕੰਮ ਨੂੰ ਕੰਮ ਰਾਹ ਦਿੰਦਾ ਅਤੇ ਜਦੋਂ ਕੰਮ ਕਰੀਏ ਜਦੋਂ ਕੰਮ ਕਰਨ ਲੱਗੇ ਨਾ ਬੰਦਾ ਉਦੋਂ ਆਪਦੇ ਆਪ ਹੀ ਪਤਾ ਲੱਗ ਜਾਂਦਾ ਵੀ ਆਹ ਰਸਤਾ ਕਿੱਧਰ ਨੂੰ ਜਾਂਦਾ ਅਤੇ ਆਹ ਇਹਨੂੰ ਐਂ ਕਰਨਾ ਕੰਮ ਆਪੇ ਹੀ ਸਿੱਖਿਆ ਦਿੰਦਾ ਦੱਸਦਾ ਵੀ ਮੈਨੂੰ ਇਸ ਤਰ੍ਹਾਂ ਕਰ ਆਪੇ ਫਿਰ ਪਤਾ ਲੱਗ ਜਾਂਦਾ ਬੰਦੇ ਨੂੰ ਬਾਕੀ ਕਈਆਂ ਨੂੰ ਦੱਸੇ ਤੋਂ ਕੰਮ ਆਉਂਦਾ ਕਈਆਂ ਨੂੰ ਵੇਖੇ ਤੋਂ ਆ ਜਾਂਦਾ ਕਈਆਂ ਨੂੰ ਪ੍ਰੈਕਟਿਸ ਕਰਕੇ ਫਿਰ ਸਿੱਖ ਦਾ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਬਾਕੀ ਬਹੁਤ ਕੰਮ ਕੀਤੇ ਆ ਸਿਲਾਈਆਂ ਬੁਣੀਆਂ ਜਾਕਟਾਂ ਬੁਣੀਆਂ ਘਰ ਦਾ ਕੱਪੜਾ ਬਣਾ ਕੇ ਪਾਈਦਾ ਸੀ ਅਸੀਂ ਤਾਂ ਅਜੇ ਵੀ ਆਪਦੇ ਘਰ ਦੇ ਹੀ ਪਾਉਂਦੇ ਆ ਅਸੀਂ ਬਾਜ਼ਾਰੋਂ ਕਦੇ ਨਹੀਂ ਸਵਾਏਗੇ ਅਤੇ ਬੱਚਿਆਂ ਨੇ ਸਿੱਖਿਆ ਜ਼ਰੂਰ ਆ ਅਤੇ ਮੇਰੇ ਮੈਂ ਆਪਦੀਆਂ ਲੜਕੀਆਂ ਨੂੰ ਵੀ ਇਵੇਂ ਸਿਖਾਇਆ ਉਹ ਵੀ ਬਹੁਤ ਉਹਨਾਂ ਨੇ ਸਿਲਾਈ ਦਾ ਕੰਮ ਕੀਤਾ ਆਪਦੇ ਘਰਾਂ 'ਚ ਵਧੀਆ ਸੋਹਣੀ ਕਮਾਈ ਕਰਕੇ ਟਾਈਮ ਪਾਸ ਕਰੀ ਜਾਂਦੀਆਂ ਅਤੇ ਕੰਮ ਬਹੁਤ ਕੀਤੇ ਆ ਇਹ ਅਤੇ ਹੁਣ ਬੱਚੇ ਜੇ ਸਮਝਣ ਤਾਂ ਜਿਹੜੀ ਕੀਮਤ ਜਿਹੜੀ ਉਹ ਸਾਡੀ ਦੇ ਕੋਈ ਦੇਣਾ ਦੇ ਨਹੀਂ ਸਕਦਾ ਗਾ ਅਤੇ ਜੋ ਹੱਥ ਦਾ ਕੰਮ ਕੀਤਾ ਹੁੰਦਾ ਨਾ ਉਹ ਹੀ ਉਹਦੀ ਉਹਦੀ ਉਹਦੀ ਕਦਰ ਕੀਮਤ ਪੈਂਦੀ ਆ ਹੱਥ ਦਾ ਆਪਦੇ ਹੱਥੀਂ ਕੰਮ ਕੀਤਾ ਹੋਇਆ ਬੰਦਾ ਭੁੱਖਾ ਨਹੀਂ ਮਰਦਾ ਮਿਹਨਤ ਕੀਤੀ ਹੋਈ ਉਹਦੀ ਉਹ ਰੰਗ ਜ਼ਰੂਰ ਲਿਆਉਂਦੀ ਹੈ ਆਪਦੇ ਹੱਥੀਂ ਕੰਮ ਕਰੋ ਹੱਥੀਂ ਕਰਕੇ ਕੁਝ ਨਾ ਕੁਝ ਸਿੱਖੋ ਅਤੇ ਕੁਝ ਪਾਓ ਬੰਦਾ ਇਸੇ ਤਰ੍ਹਾਂ ਹੀ ਸੋਹਣਾ ਲੱਗਦਾ ਅਤੇ ਬਾਕੀ ਆਪਦੀ ਕਮਾਈ ਆਪੇ ਕਰੋ ਜੇ ਆਪਦੀ ਕਮਾਈ ਕੀਤੀ ਹੋਵੇਗੀ ਤਾਂ ਕਿਸੇ ਕੋਲੋਂ ਕੁਛ ਮੰਗਣ ਦੀ ਲੋੜ ਨਹੀਂ ਪਏਗੀ ਆਪਦੀ ਕਮਾਈ ਜਿੱਥੇ ਮਰਜ਼ੀ ਬਹਿ ਕੇ ਰੋਟੀ ਖਾ ਲਵੋ ਸਾਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਅਤੇ ਸੋ ਇਸੇ ਕਰਕੇ ਬੱਚਿਆਂ ਨੂੰ ਵੀ ਇਹੋ ਹੀ ਸ਼ਿਕਸ਼ਾ ਦਿੰਦੇ ਹਾਂ ਵੀ ਆਪਦੇ ਹੱਥੀਂ ਕੰਮ ਕਰੋ ਅਤੇ ਹੱਥੀਂ ਸਿੱਖੋ ਅਤੇ ਸੋਹਣਾ ਬੋਲੋ ਮਿੱਠਾ ਬੋਲੋ ਅਤੇ ਰੱਜ ਕੇ ਖਾਓ ਆਪ ਦੀ ਜਿਹੜੀ ਰਸਨਾ ਆ ਇਹ ਇਹ ਇਹ ਕਿਸੇ ਨੇ ਖੋਹ ਨਹੀਂ ਲੈਣੀ ਇਹ ਤਾਂ ਆਪਦੇ ਵਿੱਚ ਗੁਣ ਹੋਣੇ ਚਾਹੀਦੇ ਬੰਦੇ ਦੇ